ਪੰਜਾਬ ਦੇ ਵਿੱਚ ਪੰਜਾਬੀ ਦੀਆਂ ਚਾਰ ਉਪ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿਵੇਂ ਮਾਝੀ ਮਲਵਈ ਦੁਆਬੀ ਪੁਆਧੀ ਅਤੇ ਉਸ ਤੋਂ ਬਾਅਦ ਇਹ ਸਭ ਜਿਵੇਂ ਜਿਵੇਂ ਅਸੀਂ ਵੀਹ ਕਿਲੋਮੀਟਰ ਦਸ ਕਿਲੋਮੀਟਰ ਅੱਗੇ ਜਾਂਦੇ ਹਾਂ ਉਵੇਂ ਹੀ ਸੱਭਿਆਚਾਰ ਦੇ ਨਾਲ ਨਾਲ ਬੋਲੀਆਂ ਵੀ ਬਦਲੀਆਂ ਜਾਂਦੀਆਂ ਨੇ ਪਹਿਲਾਂ ਸੱਭਿਆਚਾਰ ਕੁਛ ਹੋਰ ਹੁੰਦਾ ਸੀ ਅਤੇ ਅੱਜ ਦੇ ਟਾਈਮ 'ਚ ਸੱਭਿਆਚਾਰ ਕੁਛ ਹੋਰ ਹੈ ਪਹਿਲੇ ਟਾਈਮ ਦੇ ਸੱਭਿਆਚਾਰ ਦੇ ਵਿੱਚ ਜਿਵੇਂ ਕੁੜੀਆਂ ਸੂਟ ਸਲਵਾਰ ਪਾਉਂਦੀਆਂ ਸੀ ਅਤੇ ਮੁੰਡੇ ਕੁੜਤੇ ਪਜਾਮੇ ਪਾਉਂਦੇ ਹੁੰਦੇ ਸੀ ਅਤੇ ਅੱਜ ਦਾ ਉਹ ਵੈਸਟਰਨ ਅਤੇ ਅੱਜ ਉਹ ਟਾਈਮ ਵੈਸਟਰਨ ਕਲਚਰ ਦੇ ਵਿੱਚ ਬਦਲ ਗਿਆ ਅਤੇ ਉਸ ਤੋਂ ਬਾਅਦ ਜਿਹੜੀ ਪੰਜਾਬੀ ਬੋਲੀ ਆ ਉਹ ਘੱਟਦੀ ਜਾ ਰਹੀ ਆ ਕਿਉਂਕਿ ਜਿਹੜੇ ਅੱਜ ਦੇ ਅੱਜ ਦੇ ਬੱਚੇ ਨੇ ਉਹ ਪੰਜਾਬ ਪੰਜਾਬੀ ਬੋਲਣ ਨਾਲੋਂ ਇੰਗਲਿਸ਼ ਅਤੇ ਹਿੰਦੀ ਬੋਲਣੀ ਜ਼ਿਆਦਾ ਪਸੰਦ ਕਰਦੇ ਨੇ ਘਰਾਂ ਦੇ ਵਿੱਚ ਵੀ ਹਿੰਦੀ ਬੋਲਦੇ ਨੇ ਅਤੇ ਸਕੂਲਾਂ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਪੰਜਾਬੀ ਲਾਜ਼ਮੀ ਨਹੀਂ ਹੈ ਅੱਜ ਦੇ ਟਾਈਮ ਦੇ ਵਿੱਚ ਅਤੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਫਾਈਨ ਵੀ ਦੇ ਦਿੱਤਾ ਜਾਂਦਾ ਅਗਰ ਉਹ ਪੰਜਾਬੀ ਦੀ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਨੇ ਅਤੇ ਉਸ ਤੋਂ ਬਾਅਦ ਅਗਰ ਆਪਾਂ ਭਾਸ਼ਾ ਦੀ ਗੱਲ ਕਰੀਏ ਤਾਂ ਭਾਸ਼ਾ ਨੂੰ ਅਸੀਂ ਕਿਵੇਂ ਪ੍ਰਚਾਰ ਕਰ ਸਕਦੇ ਹਾਂ ਸਕੂਲਾਂ ਦੇ ਵਿੱਚ ਲਾਜ਼ਮੀ ਬਣਾਉਣੀ ਚਾਹੀਦੀ ਹੈ ਪੰਜਾਬੀ ਭਾਸ਼ਾ ਤਾਂ ਕਿ ਬੱਚਿਆਂ ਨੂੰ ਪੰਜਾਬੀ ਬੋਲਣੀ ਆ ਸਕੇ ਅਤੇ ਉਸ ਤੋਂ ਬਾਅਦ ਅਸੀਂ ਆਪਣੇ ਪੰਜਾਬ ਦੇ ਵਿੱਚ ਜਿਵੇਂ ਆਪਣੇ ਦੁਕਾਨਾਂ ਦੇ ਅੱਗੇ ਬੋਰਡ ਲੱਗੇ ਵੇ ਹੁੰਦੇ ਆ ਅਸੀਂ ਉਹ ਵੀ ਪੰਜਾਬੀ ਦੇ ਵਿੱਚ ਲਿਖ ਸਕਦੇ ਹਾਂ ਅਤੇ ਸਾਨੂੰ ਪੰਜਾਬੀ ਦੇ ਬਾਰੇ ਅਲੱਗ ਅਲੱਗ ਜਾ ਕੇ ਜ਼ਿਲ੍ਹਿਆਂ ਦੇ ਵਿੱਚ ਜਾਂ ਸਾਨੂੰ ਪਿੰਡਾਂ ਦੇ ਵਿੱਚ ਜਾ ਕੇ ਸਾਨੂੰ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਕਈ ਤਰ੍ਹਾਂ ਦੇ ਸਾਨੂੰ ਪ੍ਰੋਗਰਾਮ ਕਰਵਾਉਣੇ ਚਾਹੀਦੇ ਪੰਜਾਬੀ ਭਾਸ਼ਾ ਬਾਰੇ ਦੱਸਣਾ ਚਾਹੀਦਾ ਕਿਵੇਂ ਪੰਜਾਬੀ ਭਾਸ਼ਾ ਅਲੋਪ ਹੁੰਦੀ ਜਾ ਰਹੀ ਆ ਇਸ ਚੀਜ਼ ਬਾਰੇ ਅਸੀਂ ਦੱਸ ਸਕਦੇ ਹਾਂ ਲੋਕਾਂ ਨੂੰ ਅਸੀਂ ਵੱਧ ਤੋਂ ਵੱਧ ਜਾਣਕਾਰੀ ਵੀ ਦੇ ਸਕਦੇ ਹਾਂ ਅਤੇ ਸਾਨੂੰ ਪੰਜਾਬੀ ਦੇ ਵਿੱਚ ਜਿਹੜੀਆਂ ਸਾਡੇ ਨਾਵਲਕਾਰ ਹੋਏ ਨੇ ਉਹਨਾਂ ਬਾਰੇ ਅਸੀਂ ਉਹਨਾਂ ਦਾ ਪ੍ਰਚਾਰ ਕਰ ਸਕਦੇ ਉਹਨਾਂ ਦੀ ਬੁੱਕਸ ਅਸੀਂ ਦੇ ਸਕਦੇ ਹਾਂ ਲੋਕਾਂ ਦੇ ਵਿੱਚ ਵੰਡ ਸਕਦੇ ਹਾਂ